ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਗੁਪਤਾ ਅਲਟਰੋਨੀ ਗੁਪਤਾ ਤੋਂ ਬੋਲ ਰਹੇ ਓਂ ਸਰ ਸਰ ਮੈਂ ਤੁਹਾਡੇ ਤੋਂ ਡੱਬ ਦਾ ਸ਼ੈਂਪੂ ਮੰਗਵਾਇਆ ਸੀ ਉਹਦੇ ਨਾਲ ਮੈਨੂੰ ਇੰਨੇ ਰ ਫ਼ਾਇਦੇ ਮਿਲੇ ਹੈ ਕਿ ਮੈਂ ਦੱਸ ਨਹੀਂ ਸਕਦੀ ਸਰ ਮੇਰੇ ਵਾਲ ਪਹਿਲਾਂ ਬਹੁਤ ਝੜਦੇ ਸੀ ਹੁਣ ਝੜਨੇ ਬੰਦ ਹੋ ਗਏ ਨੇ ਡੱਵ ਦੇ ਸ਼ੈਂਪੂ ਨਾਲ ਮੇਰੇ ਵਾਲ ਸਮੂਥਨਿੰਗ ਸਮੂਥਨਿੰਗ ਹੋ ਗਏ ਹਨ ਇਸ ਸੈਂਪੂ ਨਾਲ ਮੈਨੂੰ ਬਹੁਤ ਜ਼ਿਆਦਾ ਫ਼ਾਇਦੇ ਮਿਲੇ ਹਨ ਇਸ ਸ਼ੈਂਪੂ ਨਾਲ ਮੇਰੇ ਜੋ ਵਾਲ ਪੂਰੇ ਰਫ ਹੋ ਚੁੱਕੇ ਸੀ ਉਹ ਵੀ ਪੂਰੇ ਸ਼ਾਈਨਿੰਗ ਕਰਨ ਲੱਗ ਗਏ ਹਨ ਇੰਝ ਇਸ ਡੱਵ ਦੇ ਸ਼ੈਂਪੂ ਨਾਲ ਵਾਲਾਂ ਦਾ ਟੁੱਟਣਾ ਝੜਨਾ ਸਭ ਕੁਛ ਬੰਦ ਹੋ ਗਿਆ ਵਾਲ ਇੰਨੇ ਸਿਲਕੀ ਸ਼ਾਈਨਰ ਅਤੇ ਸਮੂਥਨਿੰਗ ਹੋ ਗਏ ਆ ਕਿ ਪੁੱਛੋ ਹੀ ਨਾ ਮੈਂ ਸਰ ਮੈਂ ਡੱਵ ਦੇ ਸ਼ੈਂਪੂ ਤੋਂ ਇੰਨੀ ਖੁਸ਼ ਹਾਂ ਕਿ ਮੈਨੂੰ ਹੁਣ ਕੋਈ ਹੋਰ ਸ਼ੈਂਪੂ ਕੰਡੀਸ਼ਨਰ ਵਧੀਆ ਹੀ ਨਹੀਂ ਲੱਗਦਾ ਮੈਂ ਹਮੇਸ਼ਾਂ ਡੱਵ ਦਾ ਸੈਂਪੂ ਅਤੇ ਕੰਡੀਸ਼ਨਰ ਹੀ ਵਰਤਦੀ ਹਾਂ ਸਾਡੀ ਸਾਰੇ ਘਰਦਿਆਂ ਨੂੰ ਹੀ ਪਰਿਵਾਰਿਕ ਮੈਂਬਰਾਂ ਨੂੰ ਮੈਂ ਡੱਵ ਦਾ ਸ਼ੈਂਪੂ ਵਰਤਣ ਦੀ ਸਲਾਹ ਦਿੰਦੀ ਹਾਂ ਇਸ ਨਾਲ ਵਾਲ ਇੰਨੇ ਹਲਕੇ ਫੀਲ ਹੁੰਦੇ ਹਨ ਕਿ ਕੋਈ ਵੀ ਉਹ ਸੈਡੀ ਫੈਕਟ ਨਹੀਂ ਹੁੰਦਾ ਇਸ ਨਾਲ ਇਸਦੇ ਚੰਗੇ ਹੀ ਰਿਜਲਟ ਮਿਲਦੇ ਹਨ ਇਸ ਨਾਲ ਵਾਲ ਇੰਨੀ ਸ਼ਾਈਨਿੰਗ ਕਰਦੇ ਹਨ ਕਿ ਹਰ ਇੱਕ ਪੁੱਛਦਾ ਹੈ ਕਿ ਕਿਹੜਾ ਸ਼ੈਂਪੂ ਇਸਤੇਮਾਲ ਕਰਦੀ ਹਾਂ ਡੱਵ ਦਾ ਸ਼ੈਂਪੂ ਲਵ ਇਟ ਬਹੁਤ ਘੈਂਟ